ਉੱਨੀ ਸੌ ਪਚਾਸੀ ਇੱਕੀ ਹਜ਼ਾਰ ਪੰਜਾਹ ਹਜ਼ਾਰ ਦੋ ਸੌ ਤਰਾਨਵੇਂ ਦੋ ਲੱਖ ਤਿੰਨ ਹਜ਼ਾਰ ਪੰਜ ਲੱਖ ਤਿੰਨ ਹਜ਼ਾਰ ਦੋ ਸੌ ਚੁਰਾਨਵੇਂ